ਹੋਲੋ ਹਾਂਜੀ ਜੀ ਗੁੱਡ ਆਫਟਰਨੂਨ ਮੈਮ ਹਾਂਜੀ ਮੈਂ ਬਲਜੀਤ ਦੀ ਮੰਮਾ ਬੋਲ ਰਹੀ ਹਾਂ ਅਤੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨੀ ਸੀ ਅਤੇ ਗੱਲ ਇੱਦਾ ਮੈਮ ਮੈਂ ਨਾ ਸਿਕਸਥ ਕਲਾਸ ਦਾ ਨਾ ਲੈਸਨ ਪਲੈਨ ਬਣਾਏ ਗਏ ਠੀਕ ਹੈ ਅਤੇ ਉਹ ਚਾਲੀ ਬਣਾਉਣੇ ਮਤਲਬ ਵੀਕਲੀ ਉਹਦੇ 'ਚ ਕਿੰਨਾ ਉਹਦੇ ਵਿੱਚ ਜਿਹੜਾ ਵਾ ਉਹ ਸਿਲੇਬਸ ਦਿੰਦੇ ਅਤੇ ਮੈਂ ਉਹਦੇ ਨਹੀਂ ਨਹੀਂ ਪਹਿਲਾਂ ਫਸਟ ਟਰਮ ਦੇ ਓਨਲੀ ਫਸਟ ਵੀਕ ਲਈ

ਮੈਂ ਉਹਦੇ ਵਿੱਚ ਤਿੰਨ ਚੈਪਟਰ ਰੱਖੇ ਜੇ ਠੀਕ ਹੈ ਕਿਉੰਕਿ ਇਹਦੇ ਲਈ ਇੱਕ ਵੀਕ 'ਚ ਹੋ ਜਾਵੇਗਾ ਕੁਸ਼ਚਨ ਆਨਸਰ ਪਹਿਲਾਂ ਹੀ ਰਹਿੰਦੇ ਆ ਲਾਸਟ ਚੈਪਟਰ ਦੇ ਚਲੋ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਹਾਂਜੀ ਹਾਂਜੀ ਅਤੇ ਮੈਮ ਮੈਂ ਇੱਦਾਂ ਕਰ ਲੈਂਦੀ ਹਾਂ ਕਿ ਇੱਕ ਹਫਤੇ ਵਿੱਚ ਦੋ ਚੈਪਟਰ ਰੱਖ ਦਿੰਦੀ ਹਾਂ ਵਿੱਧ ਕੁਸ਼ਚਨ ਆਨਸਰ ਬੈਕ ਐਕਸਾਈਜ਼ ਸਾਰਾ ਕੁਛ ਉਹਦਾ ਕੰਪਲੀਟ ਜੀ ਮੈਂ ਉਹ ਫ੍ਰੀ ਪਲੈਨਿੰਗ ਦੇਖ ਲਈ ਉਹਦੇ ਵਿੱਚ ਹਲੇ ਜੇ ਹੋਰ ਥੋੜ੍ਹਾ ਵੀ ਇੱਕ ਆਪਾਂ ਔਲ ਸਕੂਲ ਨੂੰ ਅਟੈਂਡ ਕਰਨਾ ਵਾ ਬੱਚਿਆਂ ਨੇ ਵੀ ਆਉਣਾ ਵਾ ਹਾਂਜੀ ਹਾਂਜੀ ਬਸ ਜੀ ਇਹ ਹੀ ਸੀਗਾ ਮੈਮ ਓਕੇ ਥੈਂਕ ਯੂ ਥੈਂਕ ਯੂ ਸੋ ਮਚ